ਜਿੱਦਾਂ ਕਿ ਸਭ ਤੋਂ ਪਹਿਲਾਂ ਤਾਂ ਇਹ ਮੇਰੀ ਮਾਤ ਭਾਸ਼ਾ ਹੈ ਅਤੇ ਸਭ ਤੋਂ ਪਹਿਲਾਂ ਬਚਪਨ ਵਿੱਚ ਮੈਂ ਆਪਣੇ ਘਰ ਵਿੱਚ ਆਪਣੀ ਮਾਤਾ ਪਿਤਾ ਅਤੇ ਨਾਲ ਦੇ ਸਹਿਯੋਗੀਆਂ ਨਾਲ ਪੰਜਾਬੀ ਸਿੱਖੀ ਪਰ ਜਿੱਦਾਂ ਜਿੱਦਾਂ ਮੈਂ ਵੱਡਾ ਹੁੰਦਾ ਗਿਆ ਤਾਂ ਘਰੋਂ ਬਾਹਰ ਮੁਹੱਲੇ ਪਿੰਡ ਜਾਂ ਸਕੂਲ ਗਿਆ ਤਾਂ ਉੱਥੋਂ ਵੀ ਮੈਂ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਸਿੱਖੇ ਤੇ ਅਤੇ ਜਦੋਂ ਮੈਂ ਪੰਜਾਬੀ ਸਕੂਲ ਵਿੱਚ ਪੜ੍ਹੀ ਤਾਂ ਉੱਥੋਂ ਵਿਆਕਰਨ ਦੇ ਬਹੁਤ ਸ਼ਬਦ ਸਿੱਖੇ ਤਾਂ ਮੈਂ ਇਹ ਸਿੱਖਿਆ ਕਿ ਪੰਜਾਬੀ ਨੂੰ ਐਕਚੂਅਲ ਵਿੱਚ ਕਿੱਦਾਂ ਬੋਲਿਆ ਜਾਂਦਾ ਹੈ ਆਮ ਤੋਰ 'ਤੇ ਆਮ ਤੋਰ 'ਤੇ ਘਰਾਂ 'ਚ ਅਸੀਂ ਸਿੰਪਲ ਪੰਜਾਬੀ ਬੋਲ ਲੈਂਦੇ ਹਾਂ ਪਰ ਐਕਚ ਅਸਲੀ ਪੰਜਾਬੀ ਜਿਸ ਵਿੱਚ ਪੂਰਾ ਵਿਆਕਰਨ ਦੀ ਲੋੜ ਪੈਂਦੀ ਹੈ ਉਹ ਮੈਂ ਸਿੱਖੀ ਸਕੂਲ ਵਿੱਚ ਜਾ ਕੇ ਅਤੇ ਮੈਂ ਸਿੱਖਿਆ ਕਿ ਪੰਜਾਬੀ ਇੱਕ ਬਹੁਤ ਪਿਆਰੀ ਲੈਂਗੂਏਜ ਹੈ ਪੰਜਾਬੀ ਬੋਲਦੇ ਸਮੇਂ ਹਮੇਸ਼ਾ ਬੰਦਾ ਖੁਸ਼ਨੁਮਾ ਹੀ ਲੱਗਦਾ ਹੈ ਇਹ ਕਦੇ ਨਹੀਂ ਲੱਗਦਾ ਕਿ ਬੰਦਾ ਦੁਖੀ ਹੋਵੇਗਾ ਇਹ ਇਸ ਦਾ ਅਸਰ ਹੈ ਕਿ ਪੰਜਾਬੀ ਜਦੋਂ ਵੀ ਕੋਈ ਬੋਲਦਾ ਹੈ ਤਾਂ ਉਸਨੂੰ ਪੰਜਾਬੀ ਇੰਨੀ ਪਿਆਰੀ ਲੱਗ ਜਾਂਦੀ ਹੈ ਕਿ ਹਮੇਸ਼ਾ ਉਹ ਪੰਜਾਬੀ ਨੂੰ ਹੀ ਸਭ ਤੋਂ ਉੱਤੇ ਰੱਖਦਾ ਹੈ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਇਹੋ ਜਿਹੇ ਸ਼ਬਦ ਹਨ ਜੋ ਕਿ ਇੱਕ ਬੰਦੇ ਨੂੰ ਦੂਜੇ ਬੰਦੇ ਨਾਲ ਬਹੁਤ ਜ਼ਿਆਦਾ ਜੋੜ ਕੇ ਰੱਖਦੇ ਹਨ ਅਤੇ ਪਿਆਰ ਨਾਲ ਬੁਲਾਉਣ ਦੀ ਰੱਖਦੇ ਹਨ ਜਿੱਦਾਂ ਕਿ ਅਸੀਂ ਆਮ ਤੌਰ 'ਤੇ ਪਿੰਡਾਂ 'ਚ ਇੱਕ ਦੂਜੇ ਨੂੰ ਬੁਲਾਉਂਦੇ ਹਾਂ ਤਾਂ ਲੋਕ ਬਹੁਤ ਖੁਸ਼ ਹੁੰਦੇ ਹੈ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਕੇ